ਕੋਵਿਡ ਉੱਨੀ ਮਹਾਂਮਾਰੀ ਦੌਰਾਨ ਸਾਡੇ ਖੇਤਰ ਵਿੱਚ ਸਥਿਤੀ ਜਦੋਂ ਕੋਵਿਡ ਉੱਨੀ ਨਵੀਂ ਨਵੀਂ ਬਿਮਾਰੀ ਫੈਲੀ ਤਾਂ ਜ਼ਿਆਦਾ ਸਥਿਤੀ ਤਨਾਅਪੂਰਨ ਹੋ ਗਈ ਸੀ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਹੀ ਲੋਕਾਂ ਨੇ ਆਪੋ ਆਪਣਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ ਇਕੱਠ ਕਰਨੇ ਬੰਦ ਕਰ ਦਿੱਤੇ ਆਪੋ ਆਪਣੇ ਘਰਾਂ 'ਚ ਰਹਿਣਾ ਇੱਕ ਦੂਜੇ ਤੋਂ ਫ਼ਾਸਲੇ ਰੱਖਣੇ ਸ਼ੁਰੂ ਕਰ ਦਿੱਤੇ ਫਿਰ ਸਾਡੇ ਖੇਤਰ ਵਿੱਚ ਸਥਿਤੀ ਜਿਹੜੀ ਸੀ ਵਧੀਆ ਹੋ ਗਈ ਸੀ ਮੈਂ ਅਤੇ ਅਸੀਂ ਸਾਡੇ ਪਰਿਵਾਰ ਸਾਰੇ ਨੇ ਇਹ ਪੀ ਆਪੋ ਆਪਣੇ ਮਾਸਕ ਪਾਏ ਸੀ ਮੂੰਹ ਢੱਕ ਕੇ ਰੱਖੇ ਉਨੇਂ ਦਿਨ ਜ਼ਿਆਦਾਤਰ ਗਰਮ ਪਾਣੀ ਦਾ ਸੇਵਨ ਕਰਦੇ ਰਹੇ ਫਿਰ ਪਾਣੀ ਵਿੱਚ ਲੋਂਗ ਅਦਰਕ ਇਲਾਚੀ ਪਾ ਕੇ ਉਹ ਸੇਵਨ ਕਰਦੇ ਰਹੇ ਦੋ ਟਾਈਮ ਇੱਕ ਦੂਜੇ ਤੋਂ ਦੂਰੀਆਂ ਬਣਾ ਕੇ ਰੱਖੀਆਂ ਜਿਸ ਤਰ੍ਹਾਂ ਉਸ ਤੋਂ ਬਾਅਦ ਸਰਕਾਰ ਨੇ ਸਾਨੂੰ ਜੋ ਕਿ ਟੀਕਾਕਰਨ ਸ਼ੁਰੂ ਹੋ ਗਿਆ ਇਹਦੀਆਂ ਦਵਾਈ ਆ ਗਈ ਫਿਰ ਉਹਦਾ ਹੀ ਸਮੇਂ ਸਮੇਂ ਸਿਰ ਟੀਕਾਕਰਨ ਕਰਵਾਉਂਦੇ ਰਹੇ ਸਾਰੇ ਪਰਿਵਾਰ ਦੇ ਮੈਂਬਰ ਇਸ ਤਰ੍ਹਾਂ ਅਸੀਂ ਇਸ ਤੋਂ ਇਸ ਬਿਮਾਰੀ ਤੋਂ ਸੁਰੱਖਿਅਤ ਰਹੇ